ਭੋਜਨ ਨਾਲ਼ ਸੰਬੰਧਿਤ ਅੰਧ ਵਿਸ਼ਵਾਸ਼ ਤਾਂ ਮੇਰੇ ਕੋਲ ਕੋਈ ਨਹੀਂ ਹੈ ਪਰੰਪਰਾ ਹੈ ਮੇਰੇ ਇੱਕ ਕੋਲ ਜੋ ਸ਼ਾਇਦ ਮੈਨੂੰ ਆਪਣੀ ਮਾਂ ਤੋਂ ਮਿਲੀ ਹੈ ਆਪਣੀ ਮਤਲਬ ਪੇਕੇ ਘਰ ਆਪਣੀ ਮਾਂ ਤੋਂ ਮਿਲੀ ਹੈ ਉਹ ਹੈ ਕਿ ਮਤਲਬ ਖਾਣਾ ਹਮੇਸ਼ਾ ਫਰੈਸ਼ ਬਣਾਉਣਾ ਮਤਲਬ ਤਾਜ਼ਾ ਬਣਾਉਣਾ ਚਾਹੀਦਾ ਚਾਹੇ ਉਹ ਆਟਾ ਗੁੰਨ੍ਹਣਾ ਹੋਏ ਚਾਹੇ ਕੋਈ ਸਬਜ਼ੀ ਬਣਾਉਣੀ ਹੋਏ ਕੁਛ ਵੀ ਹੈ ਮਤਲਬ ਤਾਜ਼ਾ ਬਣਾਉਣਾ ਚਾਹੀਦਾ ਸਾਨੂੰ ਹਮੇਸ਼ਾ ਔਰ ਮੈਂ ਕੋਸ਼ਿਸ਼ ਵੀ ਕਰਦੀ ਹਾਂ ਜਦ ਕਿ ਮੈਂ ਮਤਲਬ ਕੰਮ 'ਤੇ ਵੀ ਜਾਂਦੀ ਹਾਂ ਮੈਂ ਫਿਰ ਵੀ ਕੋਸ਼ਿਸ਼ ਕਰਦੀ ਹਾਂ ਕਿ ਫਰੈਸ਼ ਹੀ ਸਬਜ਼ੀ ਬਣਾਵਾ ਔਰ ਆਟਾ ਜੋ ਗੁੰਨ੍ਹਾ ਔਰ ਰੋਟੀ ਹਮੇਸ਼ਾ ਮੈਂ ਓਨੀ ਹੀ ਬਣਾਉਂਦੀ ਹਾਂ ਜਿੰਨੀ ਮਤਲਬ ਖਾਣੀ ਹੈ ਮੈਂ ਕਦੇ ਵੀ ਵੇਸਟ ਨਹੀਂ ਕਰਦੀ ਉਸ ਚੀਜ਼ ਨੂੰ ਔਰ ਦੂਸਰੀ ਚੀਜ਼ ਜੋ ਹੈ ਮੈਂ ਆਪਣੀ ਮਤਲਬ ਮੇਰੇ ਹਸਬੈਂਡ ਨੂੰ ਥੋੜ੍ਹੀ ਆਦਤ ਹੈ ਮੇਰੇ ਘਰਵਾਲੇ ਨੂੰ ਪਰ ਮੈਂ ਉਹਨਾਂ ਨੂੰ ਵੀ ਹੁਣ ਉਨ੍ਹਾਂ ਦੀ ਆਦਤ ਚੇਂਜ ਕੀਤੀ ਹੈ ਕਿ ਕਦੀ ਵੀ ਜੂਠੇ ਹੱਥ ਨਹੀਂ ਲਗਾਉਣੇ ਕਿਸੀ ਵੀ ਸੁੱਚੀ ਚੀਜ਼ ਨੂੰ ਚਾਹੇ ਉਹ ਸਬਜ਼ੀ ਹੈ ਕੋਈ ਵੀ ਚੀਜ਼ ਹੈ ਮਤਲਬ ਰੋਟੀ ਲੈਣੀ ਹੈ ਚਾਹੇ ਤੁਸੀਂ ਬੋਈਏ 'ਚੋਂ ਖਾਂਦੇ ਹੋਏ ਉਦੋਂ ਵੀ ਮਤਲਬ ਮੈਂ ਹਮੇਸ਼ਾ ਬਾਅਦ 'ਚ ਹੀ ਖਾਂਦੀ ਹਾਂ ਸਭ ਨੂੰ ਦੇਣ ਤੋਂ ਬਾਅਦ ਤਾਂ ਕਿ ਮਤਲਬ ਜੂਠ ਮੂਠ ਨਾ ਰਸੋਈ 'ਚ ਹੋਏ ਜੂਠ ਤੋਂ ਇਲਾਵਾ ਔਰ ਜੋ ਹੈ ਓਹੀ ਮਤਲਬ ਕਿ ਹੱਥ ਧੋ ਕੇ ਹਰ ਇੱਕ ਚੀਜ਼ ਯੂਜ ਕਰੋ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਸਾਨੂੰ ਰਸੋਈ 'ਚ ਚੱਪਲ ਵਗੈਰਾ ਨਹੀਂ ਲੈ ਕੇ ਜਾਣੀ ਚਾਹੀਦੀ ਮੈਂ ਆਪਣੀ ਸਾਰੀ ਰਸੋਈ 'ਚ ਮੈਟ ਵਿਛਾਇਆ ਹੋਇਆ ਤਾਂ ਕਿ ਮਤਲਬ ਕੋਈ ਚੱਪਲ ਲੈ ਕੇ ਆਉਣ ਦੀ ਕੋਸ਼ਿਸ਼ ਵੀ ਨਾ ਕਰੇ ਬਾਹਰ ਹੀ ਖੋਲ੍ਹ ਦੇ ਮਤਲਬ ਇਹ ਅੰਧ ਵਿਸ਼ਵਾਸ਼ ਨਹੀਂ ਹੈ ਇਹ ਮਤਲਬ ਪਰੰਪਰਾਵਾਂ ਹੀ ਹੁੰਦੀਆਂ ਹੈ ਜੋ ਸਾਡੀ ਰਸੋਈ ਨੂੰ ਮਤਲਬ ਇੱਕ ਪਵਿੱਤਰ ਉਹ ਬਣਾ ਕੇ ਰੱਖਦੀ ਹੈ ਜਗ੍ਹਾ